ਭਾਰਤ ਨੂੰ ਭਰੋਸੇ ਦੀ ਧਰਤੀ ਨਾਲ ਜਾਣਿਆ ਜਾਂਦਾ ਹੈ ਇੱਥੇ ਬਹੁਤ ਸਾਰੇ ਧਰਮਾਂ ਨਾਲ ਸੰਬੰਧਿਤ ਲੋਕ ਰਹਿੰਦੇ ਹਨ ਅਤੇ ਹਰ ਧਰਮ ਦੀ ਆਪਣੀ ਕੋਈ ਵਿਸ਼ੇਸ਼ਤਾ ਹੈ ਕੋਈ ਪਰੰਪਰਾ ਹੈ ਕੋਈ ਵਿਸ਼ੇਸ਼ ਦਿਨ ਹੈ ਜਿਸ ਨੂੰ ਲੋਕ ਮਨਾਉਂਦੇ ਹਨ ਇਸ ਕਰਕੇ ਇੱਥੇ ਅਲੱਗ ਅਲੱਗ ਧਰਮ ਹੋਣ ਕਰਕੇ ਅਨੇਕਾਂ ਹੀ ਮੰਦਰ ਮਸਜਿਦਾਂ ਚਰਚ ਗੁਰਦੁਆਰੇ ਹਨ ਅਤੇ ਇਹਨਾਂ ਸਾਰੇ ਹੀ ਧਾਰਮਿਕ ਸਥਾਨਾਂ ਦੀ ਬਹੁਤ ਸਾਰੀ ਵਿਸ਼ੇਸ਼ਤਾ ਹੈ ਇਸ ਕਰਕੇ ਨਾ ਹੀ ਸਿਰਫ ਭਾਰਤ ਦੇ ਲੋਕ ਸਗੋਂ ਅਨੇਕਾਂ ਹੋਰ ਦੇਸ਼ਾਂ ਦੇ ਲੋਕ ਹਰ ਸਾਲ ਕਰੋੜਾਂ ਦੀ ਗਿਣਤੀ 'ਚ ਇੱਥੇ ਆਉਂਦੇ ਆਉਂਦੇ ਹਨ ਅਤੇ ਧਾਰਮਿਕ ਸਥਾਨਾਂ ਦੀ ਦਰਸ਼ਨ ਕਰਦੇ ਹਨ ਹਰੇਕ ਧਾਰਮਿਕ ਸਥਾਨ ਦਾ ਆਪਣਾ ਕੋਈ ਇਕ ਦਿਨ ਹੁੰਦਾ ਹੈ ਜਿਸ ਨੂੰ ਉਸ ਧਰਮ ਦੇ ਲੋਕ ਮਨਾਉਂਦੇ ਹਨ ਅਤੇ ਉਸ ਧਰਮ ਉਸ ਧਰਮ ਦੇ ਅਕੋਰਡਿੰਗ ਉਸ ਦਿਨ ਦੀ ਕੋਈ ਵਿਸ਼ੇਸ਼ ਮਹੱਤਤਾ ਹੁੰਦੀ ਹੈ ਭਾਰਤ 'ਚ ਬਹੁਤ ਸਾਰੀਆਂ ਧਾਰਮਿਕ ਸਸ ਸੰਸਥਾ ਧਾਰਮਿਕ ਸਥਾਨ ਹਨ ਜਿਨ੍ਹਾਂ ਦੀ ਮਹੱਤਤਾ ਹੈ ਜਿਵੇਂ ਕਿ ਵੈਸ਼ਨੂ ਦੇਵੀ ਹੈਗੀ ਹੈ ਜੰਮੂ ਐਂਡ ਕਸ਼ਮੀਰ 'ਚ ਗੋਲਡਨ ਟੈਂਪਲ ਅੰਮ੍ਰਿਤਸਰ ਚਾਹੇ ਸਿੱਖਾਂ ਦਾ ਗੁਰਦੁਆਰਾ ਹੈ ਸਨ ਟੈਂਪਲ ਉੜੀਸਾ ਚਾਹੇ ਜਗਨਨਾਥਪੁਰੀ ਹਿੰਦੂਆਂ ਦਾ ਮੰਦਰ ਹੈ ਅਮਰਨਾਥ ਦੀਆਂ ਗੁਫਾਵਾਂ ਹਨ ਜਿੱਥੇ ਅਨੇਕਾਂ ਹਿੰਦੂ ਧਰਮ ਦੇ ਲੋਕ ਹਰ ਸਾਲ ਦਰਸ਼ਨ ਲਈ ਜਾਂਦੇ ਹਨ ਅਤੇ ਕਰੋੜਾਂ ਦੀ ਗਿਣਤੀ 'ਚ ਉੱਥੇ ਮੱਥਾ ਟੇਕ ਕੇ ਆਉਂਦੇ ਨੇ ਹਰੇਕ ਧਰਮ ਦੀ ਆਪਣੀ ਕੋਈ ਵਿਸ਼ੇਸ਼ਤਾ ਹੈ ਐਵੇਂ ਹੀ ਸਿੱਖ ਧਰਮ 'ਚ ਵਿਸਾਖੀ ਦਾ ਦਿਨ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਤਾਂ ਇਹ ਵਿਸਾਖੀ ਦਾ ਦਿਨ ਧਾਰਮਿਕ ਵਿਸ਼ੇਸ਼ਤਾ ਇਸ ਕਰਕੇ ਵੀ ਹੈ ਕਿਉਂਕਿ ਇਸ ਦਿਨ ਗੁਰੂ ਇਸ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਗੁਰੂ ਸਿੱਖਾਂ ਦੇ ਦਸਵੇਂ ਗੁਰੂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸ ਦਿਨ ਨੂੰ ਲੋਕ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਨੇ ਅਤੇ ਬੜੇ ਹੀ ਧੂਮਧਾਮ ਨਾਲ ਮਨਾਉਂਦੇ ਨੇ ਇਸ ਦਿਨ ਲੋਕ ਗਿੱਧਾ ਭੰਗੜਾ ਪਾ ਕੇ ਮਨਾਉਂਦੇ ਹਨ